ਬਾਰਾਂ ਫੈਬਰੀ ਦੋ ਹਜ਼ਾਰ ਪੰਜ ਤਿੰਨ ਮਾਰਚ ਦੋ ਹਜ਼ਾਰ ਦਸ ਛੇ ਜੂਨ ਉੱਨੀ ਸੌ ਚਰੱਨਵੇ ਪੰਦਰਾਂ ਅਗਸਤ ਉੱਨੀ ਸੌ ਸਤੱਨਵੇ ਸੱਤ ਅਪ੍ਰੈਲ ਉੱਨੀ ਸੌ ਤਰੱਨਵੇ